ਹੈਲੋ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੈਂ ਅੱਜ ਬਿਮਾਰੀਆਂ ਬਾਰੇ ਘਰੇਲੂ ਜਾਂ ਵਿਸ਼ਵਾਸ ਵਿਚਾਰਾਂ ਵਿੱਚ ਬੋਲਣਾ ਚਾਹੁੰਦਾ ਹਾਂ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਅਸੀਂ ਪਿੰਡਾਂ ਵਿੱਚ ਰਹਿੰਦੇ ਹਾਂ ਜਾਂ ਪੇਂਡੂ ਖੇਤਰ ਵਿੱਚ ਰਹਿੰਦੇ ਹਾਂ ਜਿਵੇਂ ਕਿ ਸਾਨੂੰ ਛੋਟੀ ਮੋਟੀ ਬਿਮਾਰੀ ਹੁੰਦੀ ਹੈ ਜਿਵੇਂ ਖੰਘ ਜ਼ੁਕਾਮ ਹੋ ਗਿਆ ਇਸ ਬਿਮਾਰੀ ਦਾ ਇਲਾਜ ਅਸੀਂ ਪਿੰਡਾਂ ਵਿੱਚ ਹੀ ਕਰ ਸਕਦੇ ਹਾਂ ਸਾਨੂੰ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇੱਥੋਂ ਅਸੀਂ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਆਪਣੇ ਖੰਘ ਜਾਂ ਜ਼ੁਕਾਮ ਨੂੰ ਕਾਬੂ ਦੇ ਵਿੱਚ ਕਰ ਸਕਦੇ ਹਾਂ ਜਿਵੇਂ ਕਿ ਜ਼ਿਆਦਾ ਬੁਖਾਰ ਹੋ ਜਾਣਾ ਜਾਂ ਮਲੇਰੀਆ ਹੋ ਜਾਣਾ ਜਾਂ ਡੇਂਗੂ ਜਾਂ ਕੁਛ ਵੀ ਲਾ ਲਓ ਕੁਛ ਵੀ ਹੋ ਜਾਣਾ ਅਤੇ ਉਸਦਾ ਇਲਾਜ ਅਸੀਂ ਸ਼ਹਿਰੀ ਖੇਤਰ ਵਿੱਚ ਕਰਵਾਉਂਦੇ ਹਾਂ ਕਿਉਂਕਿ ਬਿਮਾਰੀ ਵੱਡੀ ਹੋਣ ਦੇ ਕਾਰਨ ਪਿੰਡਾਂ ਵਿੱਚ ਇਲਾਜ ਉੱਨਾਂ ਨਾ ਮਿਲਣ ਕਾਰਨ ਸਾਨੂੰ ਸ਼ਹਿਰ ਦੇ ਵਿੱਚੋਂ ਹੀ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਕਿਉਂਕਿ ਪਿੰਡਾਂ ਵਿੱਚ ਬਿਮਾਰੀ ਨੂੰ ਘਰੇਲੂ ਖੇਤਰ ਵਿੱਚ ਬਿਮਾਰੀ ਨੂੰ ਜਲਦ ਤੋਂ ਜਲਦ ਕਾਬੂ ਨਹੀਂ ਕੀਤਾ ਜਾਂਦਾ ਅਤੇ ਸ਼ਹਿਰੀ ਸ਼ਹਿਰੀ ਖੇਤਰ ਵਿੱਚ ਬਿਮਾਰੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਂਦਾ ਹੈ ਇਸ ਲਈ ਅਸੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਹਸਪਤਾਲਾਂ ਵਿੱਚ ਵੀ ਕਰਵਾਉਂਦੇ ਹਾਂ ਜਾਂ ਮੈਡੀਕਲ ਸਟੋਰ 'ਤੇ ਵੀ ਹੋ ਜਾਂਦਾ ਹੈ ਅਤੇ ਆਮ ਤੌਰ 'ਤੇ ਇਲਾਜ ਵੀ ਹੋ ਜਾਂਦਾ ਹੈ ਧੰਨਵਾਦ